ਜਿੱਦਾਂ ਕਿ ਸਾਡੇ ਪੰਜਾਬ ਵਿੱਚ ਜੰਗਲਾਂ ਦੀ ਸੰਖਿਆ ਬਹੁਤ ਘੱਟ ਹੈ ਬਹੁਤ ਘੱਟ ਖੇਤਰ ਹੈ ਜਿਹੜਾ ਜੰਗਲਾਂ 'ਚ ਮੰਨਿਆ ਜਾਂਦਾ ਅਤੇ ਇਸ ਵਿੱਚੋਂ ਇੱਕ ਬਹੁਤ ਹੀ ਵੱਡਾ ਖੇਤਰ ਹੈ ਜਿਹੜਾ ਕਤਲੋਰ 'ਚ ਹੈ ਬਹੁਤ ਹੀ ਨੇੜੇ ਸਾਡੇ ਪੈਂਦਾ ਕਤਲੋਰ ਗੁਰਦਾਸਪੁਰ ਤੋਂ ਲਗਭਗ ਨਹੀਂ ਤਾਂ ਗਿਆਰਾਂ ਤੋਂ ਬਾਰਾਂ ਕਿਲੋਮੀਟਰ ਦੂਰ ਪੈਂਦਾ ਹੈ ਅਤੇ ਉੱਥੇ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਜਿਸ ਦੇ ਅੰਦਰ ਪੰਜਾਬ ਸਰਕਾਰ ਨੇ ਉੱਥੇ ਇੱਕ ਵਾਇਲਡ ਲਾਈਫ ਸੈਂਚੁਰੀ ਬਣਾਉਣ ਲਈ ਪਲੈਨ ਬਣਾਇਆ ਇਸ ਵਾਇਲਡ ਲਾਈਫ ਸੈਂਚੁਰੀ ਬਣਾਉਣ ਲਈ ਉਸਨੇ ਪੈਂਤੀ ਕਰੋੜ ਰੁਪਏ ਦਿੱਤੇ ਸੀ ਇਹ ਬਨਣ ਵਿੱਚ ਤਿੰਨ ਤੋਂ ਚਾਰ ਸਾਲ ਲੱਗੇ ਤਿੰਨ ਤੋਂ ਚਾਰ ਸਾਲ ਬਣਨ ਤੋਂ ਬਾਅਦ ਜਦੋਂ ਅਸੀਂ ਦੋ ਹਜ਼ਾਰ ਬਾਈ ਦੀ ਗੱਲ ਹੈ ਜਦੋਂ ਮੈਂ ਕਾਲਜ ਵਿੱਚ ਪਹਿਲੀ ਪਹਿਲੀ ਵਾਰ ਗਿਆ ਸੀ ਤਾਂ ਸਾਡੇ ਕਾਲਜ ਦੇ ਪੇਪਰ ਹੋ ਗਏ ਸੀ ਉਸ ਤੋਂ ਬਾਅਦ ਸਾਨੂੰ ਛੁੱਟੀਆਂ ਪਈਆਂ ਤਾਂ ਅਸੀਂ ਦੋਸਤਾਂ ਨੇ ਸੋਚਿਆ ਕਿ ਅਸੀਂ ਕਿਸੇ ਥਾਂ ਘੁੰਮਣ ਜਾਂਦੇ ਹਾਂ ਤਾਂ ਅਸਾਂ ਸੋਚਿਆ ਕਿ ਇਹ ਤਾਂ ਸਾਡੇ ਨੇੜੇ ਆ ਇੱਕ ਵਾਰ ਜਾ ਕੇ ਦੇਖਦੇ ਹਾਂ ਕਿ ਇੱਥੇ ਕਿ ਬਣਿਆ ਅਤੇ ਜਦੋਂ ਅਸੀਂ ਉੱਥੇ ਤਾਂ ਗਏ ਤਾਂ ਉੱਥੇ ਬਹੁਤ ਵਧੀਆ ਸੁਵਿਧਾਵਾਂ ਸੀ ਉੱਥੇ ਸਾਈਕਲ ਗੱਡੀ ਹਰ ਚੀਜ਼ ਉਪਲੱਬਧ ਸੀ ਜੋ ਲੈ ਕੇ ਤੁਸੀਂ ਅੰਦਰ ਘੁੰਮ ਸਕਦੇ ਹੋ ਜ ਅਸੀਂ ਅਸੀਂ ਇੱਕ ਸਾਈਕਲ ਲਿਆ ਜਿਹਦੀ ਕਿ ਕੀਮਤ ਸੀ ਪੱਚੀ ਰੁਪਏ ਇੱਕ ਘੰਟੇ ਦੇ ਹਿਸਾਬ ਨਾਲ ਅਸੀਂ ਸਾਈਕਲ ਦੇ ਅੰਦਰ ਗਏ ਜਦੋਂ ਅਸੀਂ ਅੰਦਰ ਗਏ ਤਾਂ ਅਸੀਂ ਦੇਖਿਆ ਕਿ ਬਹੁਤ ਹੀ ਵਧੀਆ ਵਧੀਆ ਦਿਖਣ ਵਾਲੀ ਜਗ੍ਹਾਵਾ ਸੀ ਜਿਨਾਂ ਵਿੱਚੋਂ ਕਿ ਬਹੁਤ ਸਾਰੇ ਜਾਨਵਰ ਸੀ ਖੇਤਰ ਵਧੀਆ ਸੀ ਬੂਟੇ ਪੱਤੇ ਇੰਨੇ ਵਧੀਆ ਵਧੀਆ ਫੁੱਲ ਇੰਨੇ ਵਧੀਆ ਵਧੀਆ ਜਗ੍ਹਾ ਅਤੇ ਹਵਾ ਵਾਤਾਵਰਨ ਸਭ ਕੁਝ ਇੰਨਾ ਵਧੀਆ ਸੀ ਕਿ ਉੱਥੇ ਬਹਿਣ ਦਾ ਉੱਠਣ ਦਾ ਰਹਿਣ ਦਾ ਇੰਨਾ ਮਜ਼ਾ ਆ ਰਿਹਾ ਸੀ ਉੱਥੇ ਪਿਕਨਿਕ ਦੀ ਜਗ੍ਹਾ ਵੀ ਸੀ ਬੰਦਾ ਉਥੋਂ ਇੱਕ ਨਦੀ ਵਹਿ ਰਹੀ ਸੀ ਉਹਦੇ ਨੇੜੇ ਬਹਿਣ 'ਤੇ ਇੰਨੀ ਠੰਡੀ ਹਵਾ ਆ ਰਹੀ ਸੀ ਅਤੇ ਉੱਥੇ ਬਹਿਣ 'ਚ ਇੰਨਾ ਮਜ਼ਾ ਆ ਰਿਹਾ ਸੀ ਕਿ ਸਾਨੂੰ ਪਤਾ ਹੀ ਨਹੀਂ ਚੱਲਿਆ ਕਦੋਂ ਅਸੀਂ ਸਵੇਰ ਦੇ ਸਾਢ਼ੇ ਨੌਂ ਵਜੇ ਦੇ ਗਏ ਵੇ ਅਤੇ ਸ਼ਾਮ ਦੇ ਤਿੰਨ ਚਾਰ ਵੱਜ ਗਏ ਸਾਨੂੰ ਇੰਨਾ ਮਜ਼ਾ ਆਇਆ ਕਿ ਅਸੀਂ ਸੋਚਿਆ ਕਿ ਜਦ ਤੋਂ ਵੀ ਅੱਗੇ ਸਾਨੂੰ ਛੁੱਟੀ ਪਵੇਗੀ ਤਾਂ ਅਸੀਂ ਇਸ ਥਾਂ 'ਤੇ ਹਮੇਸ਼ਾ ਆਉਣਾ ਅਤੇ ਜਦੋਂ ਵੀ ਉਸ ਤੋਂ ਬਾਅਦ ਛੁੱਟੀ ਪੈਂਦੀ ਹੈ ਦੋ ਤਿੰਨ ਦਿਨ ਦੀ ਤਾਂ ਅਸੀਂ ਸਾਰੇ ਦੋਸਤ ਇੱਕ ਸਤ ਇੱਕੱਠਾ ਪਲਾਨ ਬਣਾ ਕੇ ਅਸੀਂ ਹਮੇਸ਼ਾ ਉੱਥੇ ਜਾਂਦੇ ਹਾਂ ਅਤੇ ਉੱਥੇ ਚਾਰ ਪੰਜ ਘੰਟੇ ਘੁੰਮਦੇ ਹਾਂ ਅਤੇ ਜਿਹੜਾ ਦਰਿਆ ਦੇ ਲਾਗੇ ਹੱਟ ਜਿਹਾ ਬਣਿਆ ਹੋਇਆ ਅਸੀਂ ਉੱਥੇ ਬੈਠਦੇ ਹਾਂ ਅਤੇ ਉੱਥੇ ਨਜ਼ਾਰੇ ਲੈਂਦੇ ਹਾਂ ਅਤੇ ਉੱਥੇ ਸਾਨੂੰ ਇਹ ਚੀਜ਼ਾਂ ਸਿੱਖਣ ਨੂੰ ਮਿਲਦੀ ਆ ਕਿ ਜ਼ਿੰਦਗੀ ਕਿੰਨੀ ਹਸੀਨ ਚੀਜ਼ ਹੈ ਅਤੇ ਇਹਨੂੰ ਕਿੰਨੇ ਵਧੀਆ ਤਰੀਕੇ ਨਾਲ ਜੀਤਾ ਜਾ ਸਕਦਾ ਅੱਜ ਦੇ ਸਮੇਂ 'ਚ ਲੋਕਾਂ ਨੂੰ ਇੰਨੀਆਂ ਟੈਨਸ਼ਨਾਂ ਹਨ ਕਿ ਲੋਕ ਆਪਣੀ ਜ਼ਿੰਦਗੀ ਚੱਜ ਨਾਲ ਨਹੀਂ ਜਿੰਦੇ ਹਨ ਪਰ ਉੱਥੇ ਜਾ ਕੇ ਅਸੀਂ ਜ਼ਿੰਦਗੀ ਦੇ ਸਾਰੇ ਟੈਂਸ਼ਨਾਂ ਨੂੰ ਭੁੱਲ ਜਾਂਦੇ ਹਨ